ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਬੋਲੋ ਹਾਂਜੀ ਸਰ ਠੀਕ ਹੈ ਹੈ ਠੀਕ ਹੈ ਜੀ ਤੁਸੀਂ ਮਤਲਬ ਲੋਕਲ ਬਠਿੰਡੇ ਹੀ ਘੁੰਮ ਘੁੰਮਣਾ ਜਾਂ ਬਠਿੰਡੇ ਦੇ ਆਸ ਪਾਸ ਜਗ੍ਹਾਵਾਂ 'ਤੇ ਜੀ ਘੁੰਮ ਠੀਕ ਹੈ ਜੀ ਜਿਵੇਂ ਮਤਲਬ ਵੀ ਆਪਾਂ ਬਠਿੰਡੇ ਕਿਲ੍ਹੇ ਵਿੱਚ ਘੁੰਮ ਸਕਦੇ ਹਾਂ ਕਿਲ੍ਹਾ ਮੁਬਾਰਕ ਅਤੇ ਉੱਥੇ ਮਤਲਬ ਵੀ ਇੱਕ ਤਾਂ ਕਿਲ੍ਹੇ ਦੇ ਬਾਰੇ ਅਲੱਗ ਤੋਂ ਤੁਹਾਨੂੰ ਜਾਣਕਾਰੀ ਮਿਲੂਗੀ ਉੱਥੋਂ ਦਾ ਬਠਿੰਡੇ ਦਾ ਇਤਿਹਾਸ ਬਾਰੇ ਜਾਣਕਾਰੀ ਮਿਲ ਜਾਊਗੀ ਅਤੇ ਇੱਕ ਮਤਲਬ ਉੱਥੇ ਤੁਸੀਂ ਗੁਰਦੁਆਰੇ ਵੀ ਜਾ ਸਕਦੇ ਹੋ ਅਤੇ ਹੋਰ ਹੋਰ ਤੁਸੀਂ ਜਿਵੇਂ ਬਠਿੰਡੇ ਦੇ ਲਾਗੇ ਹੀ ਇੱਕ ਮਤਲਬ ਵੀ ਤਲਵੰਡੀ ਸਾਬੋ ਸ਼ਹਿਰ ਪੈਂਦਾ ਟਾਊਨ ਪੈਂਦਾ ਅਤੇ ਉੱਥੇ ਤੁਸੀਂ ਸ੍ਰੀ ਦਮਦਮਾ ਸਾਹਿਬ ਜਾ ਕੇ ਮਤਲਬ ਉੱਥੇ ਜਾ ਕੇ ਘੁੰਮ ਸਕਦੇ ਹੋ ਹਾਂਜੀ ਸਰ ਉੱਥੇ ਗੁਰਦੁਆਰਾ ਸਾਹਿਬ ਆ ਪੰਜ ਤਖਤਾਂ ਦੇ ਵਿੱਚੋਂ ਇੱਕ ਗੁਰਦੁਆਰਾ ਅਤੇ ਹਾਂ ਇਹ ਵੀ ਬਠਿੰਡੇ ਹੀ ਨੇ ਜੀ ਅਤੇ ਮਤਲਬ ਬਠਿੰਡੇ ਜਿੱਥੇ ਆਪਣਾ ਥਰਮਲ ਪਲਾਂਟ ਆ ਗਿਆ ਉਹਦੇ ਲਾਗੇ ਹੀ ਆ ਅਤੇ ਹੋਰ ਬਠਿੰਡੇ ਦੇ ਵਿੱਚ ਹੋਰ ਮਾਲ ਵੀ ਵਗੈਰਾ ਵੀ ਬਹੁਤ ਨੇ ਤਾਂ ਤੁਸੀਂ ਉੱਥੇ ਜਾ ਕੇ ਵੀ ਘੁੰਮ ਸਕਦੇ ਹੋ ਅਤੇ ਮਤਲਬ ਵੀ ਇੱਕ ਮਤਲਬ ਜਿਵੇਂ ਕੱਲ੍ਹ ਨੂੰ ਐਤਵਾਰ ਆ ਅਤੇ ਉੱਥੇ ਸੰਡੇ ਸੈਲ ਵਗੈਰਾ 'ਤੇ ਤੁਸੀਂ ਵਧੀਆ ਕੱਪੜੇ ਵਗੈਰਾ ਵੀ ਖਰੀਦ ਸਕਦੇ ਹੋ ਜਿਹੜੇ ਸਸਤੇ ਮਿਲ ਜਾਣਗੇ ਤੁਹਾਨੂੰ ਅਤੇ ਹੋਰ ਕੋਈ ਜਿਵੇਂ ਮਤਲਬ ਆਪਣੇ ਇੱਥੇ ਮਿਊਜਮ ਵਗੈਰਾ ਵੀ ਹੈਗੇ ਆ ਜਾਂ ਮਤਲਬ ਵੀ ਸੈਂਟਰਲ ਯੂਨੀਵਰਸਿਟੀ ਹੈਗੀ ਆ ਪੰਜਾਬ ਦੀ ਨਾਲ ਹੀ ਆ ਥੋੜ੍ਹੀ ਦੂਰ 'ਤੇ ਤਾਂ ਉੱਥੇ ਜਾ ਕੇ ਤੁਸੀਂ ਮੰਨ ਲਓ ਘੁੰਮ ਫਿਰ ਸਕਦੇ ਹੋ ਅਤੇ ਉੱਥੋਂ ਦੇ ਉਹਦੇ ਬਾਰੇ ਵੀ ਜਾਣਕਾਰੀ ਲੈ ਸਕਦੇ ਹੋ ਅੱਛਾ ਹਾਂਜੀ ਹਾਂਜੀ ਉੱਥੇ ਵੀ ਜਾ ਸਕਦੇ ਤੁਸੀਂ ਅਤੇ ਉਹ ਵੀ ਮਤਲਬ ਨਾਲ ਹੀ ਪੈਂਦਾ ਥੋੜ੍ਹਾ ਬਠਿੰਡੇ ਦੇ ਅਤੇ ਉਹਦੇ ਬਾਰੇ ਕੋਈ ਖ਼ਾਸ ਇੰਨੀ ਜਾਣਕਾਰੀ ਨਹੀਂ ਮੈਨੂੰ ਹੈਗੀ ਪਰ ਤੁਸੀਂ ਤੁਹਾਨੂੰ ਤੁਸੀਂ ਜਦੋਂ ਆਓਗੇ ਤੁਹਾਨੂੰ ਉਹਦੇ ਬਾਰੇ ਵੀ ਪਤਾ ਕਰ ਦਿੱਤਾ ਜਾਊਗਾ ਸਾਰਾ ਕੁਛ ਠੀਕ ਹੈ ਥੈਂਕ ਯੂ